ਇੱਕ ਸਤੰਬਰ ਦੋ ਹਜ਼ਾਰ ਤੇਈ ਦੋ ਅਗਸਤ ਦੋ ਹਜ਼ਾਰ ਬਾਈ ਤੇਰ੍ਹਾਂ ਮਾਰਚ ਉੱਨੀ ਸੌ ਅੱਸੀ ਪੰਦਰ੍ਹਾਂ ਜਨਵਰੀ ਉੱਨੀ ਸੌ ਸੱਠ ਅਠਾਰ੍ਹਾਂ ਫਰਵਰੀ ਉੱਨੀ ਸੌ ਸੱਤਰ